ਸਾਡਾ ਜੀਵਨ ਧਰਤੀ ਗ੍ਰਹਿ 'ਤੇ ਬੋ ਹੈ ਅਤੇ ਇੱਕ ਚੰਦਰਮਾ 'ਤੇ ਵੀ ਜੀਵਨ ਹੈਗਾ ਵਾ ਬਾਕੀ ਕਿਸੇ ਵੀ ਗ੍ਰਹਿ 'ਤੇ ਆਪਣਾ ਜੀਵਨ ਨਹੀਂ ਹੋ ਸਕਦਾ ਅੱਜ ਤੱਕ ਆਪਾਂ ਦੇਖਿਆ ਹੀ ਨਹੀਂ ਵੀ ਹੋਰ ਕਿਸੇ ਗ੍ਰਹਿ 'ਤੇ ਆਪਣਾ ਜੀਵਨ ਹੈਗਾ ਵਾ ਧਰਤੀ ਮਾਤਾ 'ਤੇ ਹੀ ਆਪਣਾ ਜੀਵਨ ਗ੍ਰਹਿ ਹੈਗਾ ਮਹਾਰਾਜ ਤੰਦਰੁਸਤੀਆਂ ਬਾ ਅਤੇ ਜਿਹੜੇ ਸਿਧਾਂਤ ਆ ਹਰਿਆਲੀ ਜਿਹੜੀ ਆ ਹਰਿਆਲੀ ਬਾਰੇ ਬਹੁਤ ਹੀ ਅਸੀਂ ਪੜ੍ਹਿਆ ਹੋਇਆ ਵਾ ਹਰਿਆਲੀ ਸਾਡੇ ਜੀਵਨ ਵਿੱਚ ਬਹੁਤ ਮਹੱਤਤਾ ਰੱਖਦੀ ਹੈ ਹਰਿਆਲੀ ਸਾਡੇ ਜੀਵਨ ਲਈ ਬਹੁਤ ਹੀ ਅੋਕਸੀਜਨ ਹਰੇਕ ਮਤਲਬ ਹਰਿਆਲੀ ਹਰਿਆਲੀ ਦੇ ਨਾਲ ਹੀ ਸਾਡਾ ਜੀਵਨ ਆ ਹਰਿਆਲੀ ਨਾਲ ਹੀ ਬੰਦੇ ਦੀ ਸਰੀਰ ਦੀ ਤੰਦਰੁਸਤੀ ਹੁੰਦੀ ਆ ਹਰਿਆਲੀ ਦੇ ਨਾਲ ਹੀ ਸਾਡਾ ਸਾਰਾ ਕੁਛ ਆ ਧਰਤੀ ਗ੍ਰਹਿ 'ਤੇ ਹੀ ਸਾਡਾ ਜੀਵਨ ਆ ਧਰਤੀ ਗ੍ਰਹਿ ਤੋਂ ਬਿਨਾਂ ਆਪਣਾ ਕੋਈ ਜੀਵਨ ਨਹੀਂ ਹੈਗਾ ਚੰਦਰਮਾ ਗ੍ਰਹਿ 'ਤੇ ਜੀਵਨ ਹੈਗਾ ਵਾ ਕਿਉਂਕਿ ਉਸ ਨੇ ਪਾਣੀ ਦੀ ਖੋਜ ਕੀਤੀ ਹੋਈ ਆ ਜਿਹੜੇ ਆਪਣੇ ਸਿਧਾਂਤ ਆ ਮਤਲਬ ਹਰਿਆਲੀ ਸਯਾਂਤ ਸਿਧਾਂਤ ਬਹੁਤ ਇਹ ਆਕਸੀਜਨ ਵੀ ਆਪਾਂ ਨੂੰ ਪ੍ਰਾਪਤ ਕਰਵਾਉਂਦਾ ਵਾ ਅਤੇ ਹਰੇਕ ਚੀਜ਼ ਮਤਲਬ ਕਿ ਹਰਿਆਲੀ ਉੱਤੇ ਹੀ ਆਪਣਾ ਜੀਵਨ ਬਹੁਤ ਹੀ ਵਧੀਆ ਬਤੀਤ ਹੁੰਦਾ ਵਾ ਹਰਿਆਲੀ ਹੀ ਆਪਣੇ ਜੀਵਨ ਲਈ ਬਹੁਤ ਹੀ ਜ਼ਰੂਰੀ ਹੈ